ਸਿਹਤ ਦੇਖ ਰੇਖ ਦੀਆਂ ਵੱਧਦੀਆਂ ਲਾਗਤਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਰਾਜ ਆਪਣੀ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਪਹੁੰਚ ਯੋਗਤਾ ਪਾਰਦਰਸ਼ਕਾਂ ਅਤੇ ਕੁਸ਼ਲਤਾ ਵਧਾਉਣ ਦੇ ਆਦੇਸ਼ ਨਾਲ ਇੱਕ ਬਹੁਪੱਖੀ ਪਹੁੰਚ ਨੂੰ ਲਾਗੂ ਕਰ ਰਹੇ ਹਨ ਬਹੁਤ ਸਾਰੇ ਰਾਜ ਘੱਟ ਆਮਦਨੀ ਵਾਲੇ ਵਿਅਕਤੀਆਂ ਨੂੰ ਕਵਰ ਕਰਨ ਲਈ ਕਫਾਇਤੀ ਦੇਖਭਾਲ ਐਕਟ ਦੇ ਤਹਿਤ ਮੈਡੀਕੇਟ ਦਾ ਵਿਸਤਾਰ ਕਰ ਰਹੇ ਹਨ ਜਿਸ ਤਰ੍ਹਾਂ ਬੀਮਾ ਰਹਿਤ ਜਾਂ ਘੱਟ ਬੀਮਤ ਆਬਾਦੀ ਤੇ ਵਿੱਤੀ ਬੋਝ ਘਟਾਇਆ ਜਾ ਰਿਹਾ ਹੈ ਰਾਜ ਰੈਗੂਲੇਟਰੀ ਉਪਭਾਵਾਂ ਦੁਬਾਰਾ ਲਾਗਤਾਂ ਨੂੰ ਨਿਯੰਤਰਿਤ ਕਰਨ ਲਈ ਵੀ ਕੰਮ ਕਰ ਰਹੇ ਹਨ ਜਿਵੇਂ ਕੀ ਨੁਕਸੇ ਵਾਲੀਆਂ ਦਵਾਈਆਂ ਵਾਲੀ ਕੀਮਤਾਂ ਵਿੱਚ ਵੱਧਦੀਆਂ ਸੀਮਾਵਾਂ ਨਿਰਧਾਰਿਤ ਕਰਨਾ ਅਤੇ ਹਸਪਤਾਲਾਂ ਨੂੰ ਸੇਵਾਵਾਂ ਲਈ ਲਾਗਤ ਅਨੁਮਾਨ ਪ੍ਰਦਾਨ ਕਰਨ ਦੀ ਮੰਗ ਕਰਨਾ ਇਸ ਤੋਂ ਇਲਾਵਾ ਰਾਜਮੁਲ ਅਧਾਰਤ ਦੇਖਭਾਲ ਮੋਡਲਾਂ ਨੂੰ ਉਸ਼ਤਾ ਉਤਸਾਹਿਤ ਕਰ ਰਹੇ ਹਨ ਜੋ ਪ੍ਰਧਾਨ ਕੀਤੀਆਂ ਗਈਆਂ ਸੇਵਾਵਾਂ ਦੀ ਮਾਤਰਾ ਦੀ ਬਜਾਏ ਮਰੀਜ਼ਾਂ ਦੇ ਨਤੀਜਿਆਂ ਤੇ ਕੇਂਦਰਿਤ ਕਰਦੇ ਹਨ ਪਰਾਦਾਤਾਵਾਂ ਨੂੰ ਉੱਚ ਗੁਣਵੰਤਾ ਦੇਖਭਾਲ ਨੂੰ ਵਧੇਰੇ ਕੁਸ਼ਲਤਾ ਨਾਲ ਪ੍ਰਦਾਨ ਕਰਨ ਲਈ ਉਤਸਾਹਿਤ ਕਰਦੇ ਹਨ ਨਵਾਰਕ ਦੇਖਭਾਲ ਅਤੇ ਸਿਹਤ ਸਿੱਖਿਆ ਵਿੱਚ ਨਿਵੇਸ਼ ਇੱਕ ਹੋਰ ਰਣਨੀਤੀ ਹੈ ਜਿਹਦਾ ਉਦੇਸ਼ ਪੁਰਾਣੀਆਂ ਬਿਮਾਰੀਆਂ ਅਤੇ ਟਾਲਣ ਯੋਗ ਹਸਪਤਾਲ ਵਿੱਚ ਦਾਖਲ ਹੋਣ ਨਾਲ ਜੁੜੇ ਲੰਬੇ ਸਮੇਂ ਦੇ ਖਰਚਿਆਂ ਨੂੰ ਘਟਾਉਣਾ ਹੈ ਪਰਦਾਤਾਵਾਂ ਵਿੱਚ ਮੁਕਾਬਲੇ ਨੂੰ ਵਧਾ ਕੇ ਅਤੇ ਕੀਮਤ ਅਤੇ ਗੁਣਵੰਤਾ ਦੇ ਆਲੇ ਦੁਆਲੇ ਪਾਰਦਰਸ਼ਤਾ ਵਧਾ ਕੇ ਰਾਜਾਂ ਦਾ ਉਦੇਸ਼ ਖਪਤਕਾਰਾਂ ਨੂੰ ਸੂਚਿਤ ਫੈਸਲੇ ਲੈਣ ਅਤੇ ਲਾਗਤਾਂ ਨੂੰ ਘਟਾਉਣ ਲਈ ਸ਼ਕਤੀ ਪ੍ਰਦਾਨ ਕਰਨਾ ਹੈ ਨਵੀਨਤਾਕਾਰੀ ਹੱਲ ਤਿਆਰ ਆ ਕਰਨ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਫੈਡਰਲ ਪ੍ਰੋਗਰਾਮਾਂ ਅਤੇ ਨਿੱਜੀ ਬੀਮਾ ਕਰਤਾਵਾਂ ਨਾਲ ਸਹਿਯੋਗ ਇਹਨਾਂ ਯਤਨਾਂ ਦਾ ਹੋਰ ਸਮਰਥਨ ਕਰਦਾ ਹੈ ਇਨਾ ਸੰਯੁਕਤ ਰਣਨੀਤੀਆਂ ਦੁਆਰਾ ਰਾਜ ਸਿਸਟਮ ਦੇ ਸਮੁੱਚੇ ਵਿੱਤੀ ਬੋਧ ਦਾ ਪ੍ਰਬੰਧਨ ਕਰਦੇ ਹੋਏ ਆਪਣੇ ਨਿਵਾਸੀਆਂ ਲਈ ਸਿਹਤ ਦੇਖਭਾਲ ਨੂੰ ਵਧੇਰੇ ਕਫਾਇਤੀ ਅਤੇ ਬਰਾਬਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ